ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਆਪਾਂ ਸਟੇਸ਼ਨਰੀ ਸ਼ੋਪ ਤੋਂ ਬੋਲ ਰਹੇ ਹਾਂਜੀ ਮਿਲ ਜਾਵੇਗੀ ਸਰ ਹਾਂਜੀ ਆਪਣੇ ਕੋਲ ਲਗਭਗ ਸਾਰੀਆਂ ਸਰ ਨੀਲਕਮਲੀ ਹੈ ਕਲਾਸਮੇਟੀ ਹੈ ਹੋਰ ਜਿਹੜੀਆਂ ਕੰਪਨੀਆਂ ਸਾਰੀਆਂ ਆਪਣੇ ਕੋਲ ਹਾਂਜੀ ਉਹ ਵੀ ਮਿਲ ਜਾਵੇਗੀ ਸਰ ਸਫੇਦ ਵੀ ਮਿਲ ਜਾਵੇਗੀ ਡੱਬੇ ਵਾਲੀ ਮਿਲ ਜਾਵੇਗੀ ਲਾਈਨਦਾਰ ਮਿਲ ਜਾਵੇਗੀ ਸਰ ਹਾਂਜੀ ਉਹ ਵੀ ਮਿਲ ਜਾਣਗੇ ਸਰ ਪ੍ਰਿੰਟਰ ਪ੍ਰਿੰ ਕਾਗਜ਼ ਸਰ ਪ੍ਰਿੰਟਰ ਵਾਲੇ ਚਾਹੀਦੇ ਆ ਸਰ ਆਪਾਂ ਨੂੰ ਹਾਂਜੀ ਹਾਂਜੀ ਮਿਲ ਜਾਣਗੇ ਸਰ ਹਾਂਜੀ ਮਿਲ ਜਾਣਗੇ ਸਰ

ਤਾਂ ਜਿਵੇਂ ਕਾਪੀ ਦੀ ਕੁਆਲਿਟੀ 'ਤੇ ਡਿਪੈਂਡ ਕਰਦਾ ਤੁਸੀਂ ਕਿਹੜੀ ਕੁਆਲਿਟੀ ਦੀ ਲੈਣਾ ਚਾਹੁੰਦੇ ਹੋ ਕਾਪੀ ਅਤੇ ਸ ਸਰ ਮਿਲ ਜਾਵੇਗੀ ਸਰ ਆਪਾਂ ਨੂੰ ਵਧੀਆ ਮਿਲ ਜਾਵੇਗੀ ਹਾਂਜੀ ਹਾਂਜੀ ਉਹ ਵੀ ਮਿਲ ਜਾਵੇਗੀ ਸਰ ਹਾਂਜੀ ਹਾਂਜੀ ਸਰ ਦੋਨੇ ਦੋਨੇ ਮਿਲ ਜਾਣਗੇ ਸਰ ਆਪਣੇ ਕੋਲ ਦੋਨੇ ਅਵੇਲੇਬਲ ਹੈਗੇ ਆ ਅਤੇ ਇੱਕ ਸਰ ਜਿਹੜੀ ਕਾਪੀ ਤੁਸੀਂ ਜਿਲਤ ਵਾਲੀ ਲੈਣੀ ਹੈ ਜਾਂ ਲੈਣੀ ਕਿਵੇਂ ਸਿੰਪਲ ਲੈਣੀ ਠੀਕ ਹੈ ਠੀਕ ਹੈ ਸਰ ਹਾਂਜੀ ਹਾਂਜੀ ਹਾਂ ਡਿਸਕਾਊਂਟ ਦੇਵਾਂਗੇ ਸਰ ਇਕੱਠੀ 'ਤੇ ਜ਼ਰੂਰ ਡਿਸਕਾਊਂਟ ਮਿਲੇਗਾ ਸਰ ਸਿੰਗਲ ਪੀਸ ਸਰ ਮਹਿੰਗਾ ਪੈਂਦਾ ਅਤੇ ਆਪਾਂ ਇਕੱਠੀ ਲਵਾਂਗੇ ਤਾਂ ਉਹਦੇ 'ਤੇ ਵਾਹਵਾ ਡਿਸਕਾਊਂਟ ਮਿਲ ਜਾਂਦਾ ਸਰ ਹਾਂਜੀ ਜਿੱਥੇ ਆਪਾਂ ਨੂੰ ਸਰ ਇੱਕ ਕਪ ਕਾਪੀ ਆ ਜਿਹੜੀ ਤੀਹ ਰੁਪਏ ਦੀ ਲੱਗਣੀ ਹੁੰਦੀ ਹੈ ਉਹ ਸਰ ਆਪਾਂ ਨੂੰ ਇਕੱਠੀ ਲਵਾਂਗੇ ਤਾਂ ਆਪਾਂ ਨੂੰ ਪੱਚੀ ਦੀ ਚੌਵੀ ਰੁਪਏ ਦੀ ਪਏਗੀ ਹਾਂਜੀ ਮਿਲ ਹਾਂਜੀ ਹਾਂਜੀ ਸਰ ਡਿਸਕਾਊਂਟ ਮਿਲੇਗਾ ਸਰ ਆਪਣੇ ਕੋਲ ਕੁਆਲਿਟੀ ਵੀ ਇੱਕਦਮ ਨਵੀਂ ਹੈਗੀ ਹੈ ਸਰ ਹਾਂਜੀ ਹਾਂਜੀ ਸਰ ਆਪਣੇ ਕੋਲ ਵਧੀਆ ਮਿਲੇਗੀ ਬਿਲਕੁਲ ਕੰਪਨੀ ਦੀ ਹੋਏਗੀ ਹਾਂਜੀ ਉਹ ਸਰ ਜਿੰਨਾ ਮਰਜ਼ੀ ਹਾਂਜੀ ਆਪਣੇ ਕੋਲ ਸਾਈਜ਼ ਸਾਰੇ ਅਵੇਲੇਬਲ ਹੈ ਸਰ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਅਵੇਲੇਬਲ ਹੈਗੇ ਆਪਣੇ

ਹਾਂਜੀ ਹਾਂਜੀ ਰਜਿਸਟਰ ਵੀ ਹੈਗੇ ਆ ਸਰ ਆਪਣੇ ਕੋਲ ਹਾਂਜੀ ਹਾਂਜੀ ਰਜਿਸਟਰ ਲੈਣੇ ਹਾਂਜੀ ਹਾਂਜੀ ਰਜਿਸਟਰ ਲੈਣੇ ਹੋਣ ਹਾਂਜੀ ਸਰ ਉਹ ਵੀ ਮਿਲ ਜਾਣਗੇ ਸਰ ਕੋਈ ਨਾ ਠੀਕ ਹੈ ਸਰ ਹਾਂਜੀ ਹਾਂਜੀ ਠੀਕ ਠੀਕ ਹੈ ਸਰ ਓਕੇ ਹਾਂਜੀ ਹਾਂਜੀ ਮਿਲ ਜਾਾਵਾਂਗੇ ਸਰ ਓਕੇ ਸਰ